ਹੈਲੋ ਵਧੀਆ ਭਾਅ ਜੀ ਤੁਸੀਂ ਸੁਣਾਓ ਨਹੀਂ ਭਾਅ ਜੀ ਆਹ ਤਾਂ ਤੁਸੀਂ ਝੂਠ ਬੋਲਣ ਡੇ ਸਾਡੇ ਤੇ ਤਾਂ ਬੜਾ ਵਧੀਆ ਕੰਮ ਚਲਣ ਡਿਆਂ ਖੇਤੀ ਤਾਂ ਬੜੀ ਵਧੀਆ ਹੋਈ ਕਰਦੀ ਹੈ ਨਹੀਂ ਭਾਅ ਜੀ ਸਾਡੇ ਤਾਂ ਇੱਥੇ ਖੇਤੀਬਾੜੀ ਤਾਂ ਇੰਨੀ ਵਧੀਆ ਹੋਇਆ ਕਰਦੀ ਹੈ ਕਿ ਲੋਕ ਖੁਸ਼ ਹੀ ਬੜੇ ਹੈ ਲੋਕ ਤਾਂ ਸਗੋਂ ਕਿਸਾਨਾਂ ਦੀ ਸਪੋਰਟ ਕਰਨ ਦੇ ਕੇ ਇੱਦਾਂ ਇੱਦਾਂ ਹੀ ਕੰਮ ਕਰੋ ਅਤੇ ਸਾਨੂੰ ਸਸਤੀਆਂ ਫਸਲਾਂ ਦਿਉ

ਨਹੀਂ ਭਾਅ ਜੀ ਆਹ ਤਾਂ ਤੁਸੀਂ ਹੁਣ ਆਪਣੇ ਵੱਲੋਂ ਬਣਾਈ ਕਰਦੇ ਹੋ ਗੱਲਾਂ ਫਰਟੀਲਾਈਜ਼ਰ ਨਾਲ ਕਦੀ ਵੀ ਪਾਣੀ ਦੀ ਘਾਟ ਨਹੀਂ ਆ ਸਕਦੀ ਫਰਟੀਲਾਈਜ਼ਰ ਸਿਰਫ ਫਸਲਾਂ ਨੂੰ ਵਧੀਆ ਬਣਾਉਣ ਵਾਸਤੇ ਹੁੰਦਾ ਵਾ ਜੋ ਕਿ ਉਹ ਹਾਂਜੀ ਵਧੀਆ ਵਾ ਨਹੀਂ ਭਾਅ ਜੀ ਇਹਦੇ ਨਾਲ ਕਿਸਾਨਾਂ ਨੂੰ ਬੜਾ ਫਾਇਦਾ ਹੋਣ ਦਿਆ ਵਾ ਕਿਸਾਨ ਬੜੇ ਖੁਸ਼ ਹੈ